ਹੈਲੋ ਹਾਂਜੀ ਗੁੱਡ ਈਵਨਿੰਗ ਹੈਗਾ ਹੈ ਤੁਸੀਂ ਅੰਮ੍ਰਿਤਸਰ ਏਅ ਏਅਰਪੋਰਟ 'ਤੇ ਜਿਸ ਵੇਲੇ ਪਹੁੰਚਦੇ ਹੋ ਉੱਥੋਂ ਉੱਥੋਂ ਟੈਕਸੀ ਲੈ ਕੇ ਸਿੱਧਾ ਤੁਸੀਂ ਗੋਲਡਨ ਟੈਂਪਲ ਆ ਜਾਓ ਗੋਲਡਨ ਟੈਂਪਲ ਦੇ ਬਾਹਰ ਪੰਜਾਬੀ ਜੁੱਤੀ ਦੀ ਦੁਕਾਨਾਂ ਮਿਲ ਜਾਣਗੀਆਂ ਫੁਲਕਾਰੀ ਦੀਆਂ ਦੁਕਾਨਾਂ ਖਟੜਾ ਜੈਮਲ ਸਿੰਘ ਤੋਂ ਮਿਲ ਜਾਣਗੀਆਂ ਹੋਰ ਜਿਹੜੀਆਂ ਚੀਜ਼ਾਂ ਵੀ ਡੇਲੀ ਯੂਜ਼ ਵਾਲੀਆਂ ਹੈਗੀਆਂ ਉੱਥੇ ਅਵੇਲੇਬਲ ਹੁੰਦੀਆਂ ਨੇ ਔਰ ਉਹ ਉਹ ਜ਼ਿਆਦਾਤਰ ਗੁਰੂ ਬਾਜ਼ਾਰ ਵਾਲੇ ਬਜ਼ਾਰ ਸ਼ਹਿਰ ਦੇ ਅੰਦਰਲੇ ਪਾਸੇ ਜਾਣਾ ਪੈਂਦਾ ਜਾਂ ਇੱਧਰ ਉਹ ਤੁਹਾਨੂੰ ਇੱਥੋਂ ਕੇਸਰ ਦਾ ਢਾਬਾ ਹੈਗਾ ਜੀ ਪ ਪਾਸੀਆਂ ਵਾਲੇ ਚੌਂਕ ਉੱਥੋਂ ਤੁਹਾਨੂੰ ਮਿਲ ਜਾਏਗਾ ਔਰ ਦੇਸੀ ਘਿਓ ਦਾ ਹੁੰਦਾ ਉਹ ਜੁੱਤੀ ਨਹੀਂ ਨਹੀਂ ਕਰੰਸੀ ਤੁਸੀਂ ਮੰਨ ਲਉ ਡਾਲਰ ਵੀ ਤੁਸੀਂ ਜੇ ਲਿਆਏ ਹੋ ਤਾਂ ਡਾਲਰ ਵੀ ਦੇ ਸਕਦੇ ਹੋ ਉਹ ਕੋਈ ਗੱਲ ਨਹੀਂ ਹੈਗੀ ਉਹਦੇ ਹਿਸਾਬ ਨਾਲ ਮੈਨੂੰ ਰੇਟਸ ਵਗੈਰਾ ਤਾਂ ਪਤਾ ਹੁੰਦਾ ਡਾਲਰ ਦਾ ਰੇਟ ਜਿਸ ਤਰ੍ਹਾਂ ਅੱਸੀ ਰੁਪਏ ਆ ਉਹਨੇ ਅੱਸੀ ਰੁਪਏ ਦੇ ਹਿਸਾਬ ਨਾਲ ਕੰਪੈਰੀਜ਼ਨ ਕਰਕੇ ਉਹਨੇ ਰੁਪਈਆ ਨੂੰ ਕਨਵਰਟ ਕਰਕੇ ਤੁਹਾਡੇ ਕੋਲ ਡਾਲਰ ਮੰਗ ਲੈਣੇ ਆ ਉਹ ਤਾਂ ਦੇਖੋ ਜੀ ਢਾਈ ਸੌ ਤੋਂ ਸ਼ੁਰੂ ਹੋ ਜਾਂਦਾ ਅਤੇ ਇਹ ਤਾਂ ਪੰਜਾਹ ਹਜ਼ਾਰ ਤੱਕ ਵੀ ਖਰਚਦੇ ਲੋਕ ਇਹ ਤਾਂ ਡਿਪੈਂਡ ਕਰਦਾ ਕੋਈ ਇਹੋ ਜਿਹੀ ਚੀਜ਼ ਲੈਣੀ ਹੈ ਸਿਲਕੀ ਚੀਜ਼ਾਂ ਵੀ ਹੈਗੀਆਂ ਔਰ ਕੋਟਨ 'ਚ ਵੀ ਮਿਲ ਜਾਣਗੇ ਸਿਲਕ 'ਚ ਵੀ ਮਿਲ ਜਾਣਗੇ ਉਹ ਨਾਲ ਹੀ ਹੁੰਦਾ ਜੀ ਸੂਟ ਦੇ ਨਾਲ ਹੀ ਮਿਲਦਾ ਦ ਦੁਪੱਟਾ ਮੈਚਿੰਗ ਦੁਪੱਟੇ ਹੁੰਦੇ ਨੇ ਹਾਂਜੀ